ਭਵਿੱਖ ਦੇ ਵਿੱਚ ਗਾਉਣ ਦਾ ਤਾਂ ਇੱਕ ਸ਼ੌਕ ਹੈ ਕਿਉਂਕਿ ਜੇਕਰ ਮੈਨੂੰ ਇਹੋ ਜਿਹਾ ਕੋਈ ਵੀ ਭਵਿੱਖ 'ਚ ਕੋਈ ਮੌਕਾ ਮਿਲਦਾ ਹੈ ਕਿ ਮੈਂ ਕਦੀ ਗਾਵਾਂ ਤਾਂ ਮੈਂ ਜ਼ਿਆਦਾਤਰ ਪਰਮਾਤਮਾ ਦੇ ਨਾਮ ਸਿਮਰਨ ਨੂੰ ਗਾ ਕੇ ਭਜਨ ਕੀਰਤਨ ਕਰਕੇ ਹੀ ਆਪਣੀ ਇਸ ਕਲਾ ਆ ਨੂੰ ਉਜਾਗਰ ਕਰਨਾ ਚਾਵਾਂਗੀ ਔਰ ਹੁਣ ਵੀ ਇਸੇ ਤਰ੍ਹਾਂ ਹੀ ਹੈ ਕਿ ਮੇਰੇ ਬਹੁਤ ਸਾਰੇ ਐਸੇ ਮਤਲਬ ਸਦੱਸਿਆ ਨੇ ਮੇਰੇ ਨਾਲ ਮੇਰੇ ਕਿੱਟੀ ਮੈਂਬਰਸ ਨੇ ਜਿਹੜੇ ਕਿ ਅਸੀਂ ਮਿਲ ਕੇ ਭਜਨ ਕੀਰਤਨ ਕਰਦੇ ਹਾਂ ਮਹੀਨੇ 'ਚ ਇੱਕ ਵਾਰੀ ਅਸੀਂ ਕੀਰਤਨ ਰੱਖਦੇ ਹਾਂ ਔਰ ਉਸ ਵਿੱਚ ਸਾਰਿਆਂ ਦੀ ਵਾਰੀ ਆਉਂਦੀ ਹੈ ਅਤੇ ਬਹੁਤ ਵਾਰ ਮੈਂ ਭਜਨ ਕੀਰਤਨ ਕੀਤਾ ਹੈ ਬਹੁਤ ਸਾਰੇ ਭਜਨ ਗਾਏ ਹਨ ਉਸ ਤੋਂ ਇਲਾਵਾ ਬਹੁਤ ਜਗ੍ਹਾ 'ਤੇ ਸਕੂਲ ਟਾਈਮ ਪੱਧਰ 'ਤੇ ਜਾਂ ਹੁਣ ਜੇ ਕਹਿ ਸਕੀਏ ਕਾਲਜ ਦੇ ਪੱਧਰ 'ਤੇ ਵੀ ਮੈਂ ਇੱਕ ਦੋ ਵਾਰੀ ਯੂਥ ਫੈਸਟੀਵਲ ਵਗੈਰਾ 'ਚ ਗਾਇਆ ਹੋਇਆ ਹੈ ਅਤੇ ਭਵਿੱਖ 'ਚ ਵੀ ਅੱਜ ਕੱਲ੍ਹ ਜਿਸ ਤਰੀਕੇ ਨਾਲ ਅ ਯੂਟਿਊਬ ਦਾ ਜਮਾਨਾ ਹੈ ਜਾਂ ਨੈਟਵਰਕ ਵਗੈਰਾ ਜ਼ਿਆਦਾ ਚੱਲਦਾ ਹੈ ਅਤੇ ਉਸ ਹਿਸਾਬ ਨਾਲ ਲੋਕ ਛੋਟੀਆ ਛੋਟੀਆਂ ਰੀਲਸ ਪਾਉਂਦੇ ਰਹਿੰਦੇ ਹਨ ਅਤੇ ਇਹਨਾਂ ਚੀਜ਼ਾਂ ਦੇ ਵਿੱਚ ਅੱਗੇ ਮੈਨੂੰ ਜੇ ਕਦੀ ਮੌਕਾ ਮਿਲਿਆ ਤਾਂ ਮੈਂ ਵੀ ਕੋਸ਼ਿਸ਼ ਕਰਾਂਗੀ ਕਿ ਮੈਂ ਆਪਣੀ ਇਸ ਕਲਾ ਨੂੰ ਵੀ ਆਪਣੇ ਲਈ ਹੀ ਆਪਣੇ ਸੁਣਨ ਦੇ ਲਈ ਹੀ ਵਾਰ ਵਾਰ ਰਿਕਾਰਡ ਕਰਕੇ ਮੈਂ ਨਹੀਂ ਚਾਹਵਾਂਗੀ ਕਿ ਲੋਕ ਸੁਣਨ ਕਿਉਂਕਿ ਕਈ ਵਾਰ ਇਨਸਾਨ ਦੇ ਵਿੱਚ ਇਨਸਾਨ ਗਲਤੀਆਂ ਦਾ ਪੁਤਲਾ ਹੈ ਤਾਂ ਬਹੁਤ ਜ਼ਿਆਦਾ ਗਲਤੀਆਂ ਵੀ ਹੋ ਜਾਂਦੀਆਂ ਹਨ ਤਾਂ ਲੱਗਦਾ ਹੈ ਕਿ ਗਲਤੀਆਂ ਕਰਕੇ ਬੇਇਜ਼ਤੀ ਕਰਾਉਣ ਨਾਲੋਂ ਵਧੀਆ ਹੈ ਕਿ ਬੰਦਾ ਆਪਣੀ ਕਲਾ ਆਪਣੇ ਤੱਕ ਹੀ ਸੁਣ ਕੇ ਅਤੇ ਆਪਣੇ ਮਨ ਪਰਚਾਵਾ ਕਰ ਸਕੇ